ਪੰਜ ਮਾਰਚ ਉੱਨੀ ਵੀਹ ਦਸ ਜਨਵਰੀ ਅਠਾਰਾਂ ਪੰਝੱਤਰ ਚੌਦਾਂ ਫਰਵਰੀ ਵੀਹ ਵੀਹ ਪੰਦਰਾਂ ਮਈ ਉੱਨੀ ਚਾਲੀ ਸੌਲਾਂ ਦਸੰਬਰ ਵੀਹ ਇੱਕੀ